ਜਿਵੇਂ ਕਿ ਪੁਰਾਣੇ ਸਮੇਂ ਵਿੱਚ ਨੱਚਨ ਜਾਂ ਗਾਇਕੀ ਨੂੰ ਗਲਤ ਸਮਝਿਆ ਜਾਂਦਾ ਸੀ ਜੇਕਰ ਕਿਸੇ ਬੱਚੇ ਨੂੰ ਨੱਚਨ ਕੁੱਦਨ ਜਾਂ ਗਾਇਕੀ ਦਾ ਸ਼ੌਂਕ ਹੁੰਦਾ ਸੀ ਤਾਂ ਉਸ ਨੂੰ ਨਚਾਰ ਜਾਂ ਲੱਚਰਪੁਣਾ ਕਿਹਾ ਜਾਂਦਾ ਸੀ ਉਹਨਾਂ ਦੇ ਘਰ ਦੇ ਵੀ ਉਹਨਾਂ ਦਾ ਵਿਰੋਧ ਕਰਦੇ ਸੀ ਬੱਚਿਆਂ ਨੂੰ ਆਪਣਾ ਸ਼ੌਂਕ ਆਪਣੇ ਅੰਦਰ ਹੀ ਦਬਣਾ ਪੈਂਦਾ ਸੀ ਇਹ ਇੱਕ ਬਹੁਤ ਵੱਡੀ ਗਲਤ ਫਹਿਮੀ ਸੀ ਡਾਂਸ ਲੱਚਰਪੁਣਾ ਨਹੀਂ ਸਗੋਂ ਇੱਕ ਹੁਨਰ ਟੈਲੈਂਟ ਹੈ ਮਾਪਿਆਂ ਨੂੰ ਆਪਣੇ ਬੱਚੇ ਦੇ ਹੁਨਰ ਨੂੰ ਪਛਾਣ ਕੇ ਉਸ ਨੂੰ ਅੱਗੇ ਵਧਣ ਦਾ ਮੌਕਾ ਜਰੂਰ ਦੇਨਾ ਚਾਹੀਦਾ ਹੈ ਘਰ ਦੇ ਸੋਚਦੇ ਸਨ ਕਿ ਸਾਡੀ ਪਿੰਡ ਜਾਂ ਬਰਾਦਰੀ ਵਿੱਚ ਬਦਨਾਮੀ ਹੋਵੇਗੀ ਕਿ ਤੁਹਾਡਾ ਜਵਾਕ ਕੀ ਲੱਚਰਪੁਣਾ ਕਰਦਾ ਹੈ ਆਂਡ ਗੁਆਂਢ ਵਿੱਚ ਵੀ ਸਾਡਾ ਮਜ਼ਾਕ ਬਨੂਗਾ ਡਾਂਸ ਕਰਨ ਵਾਲੇ ਨੂੰ ਚਰਿਤਰ ਪੱਖੋਂ ਵੀ ਗਲਤ ਸਮਝਿਆ ਜਾਂਦਾ ਸੀ ਉਹਨਾਂ ਲਈ ਹਮੇਸ਼ਾ ਹੀ ਗਲਤ ਸ਼ਬਦਾਵਲੀ ਬੋਲੀ ਜਾਂਦੀ ਸੀ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਸਨ ਜੋ ਕਿ ਸਹਿਨ ਨਹੀਂ ਹੁੰਦੇ ਸਨ ਲੋਕ ਡਾਂਸ ਨੂੰ ਚੰਗਾ ਨਹੀਂ ਸਮਝਦੇ ਸਨ ਇਸ ਡਰ ਤੋਂ ਹੀ ਘਰ ਦੇ ਆਪਣੇ ਬੱਚਿਆਂ ਦੇ ਸ਼ੌਂਕ ਮਾਰ ਦਿੰਦੇ ਸਨ ਅਤੇ ਉਹਨਾਂ ਨੂੰ ਡਾਂਸ ਵਰਗੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਨਹੀਂ ਦਿੰਦੇ ਸਨ ਕਿਉਂਕਿ ਉਹ ਸਮਾਜ ਤੋਂ ਡਰਦੇ ਸਨ ਕਿ ਜੇਕਰ ਉਹਨਾਂ ਦੇ ਬੱਚੇ ਡਾਂਸ ਵੱਲ ਜਾਣਗੇ ਤਾਂ ਸਮਾਜ ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਬੁਰਾ ਭਲਾ ਕਹਿਨਗੇ ਅਤੇ ਉਹ ਸਿਰ ਚੁੱਕ ਕੇ ਇਸ ਸਮਾਜ ਵਿੱਚ ਨਹੀਂ ਵਿਚਰ ਸਕਦੇ ਇਸ ਕਰਕੇ ਪਿਛਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਜਾਂਦਾ ਸੀ ਤੇ ਉਹਨਾਂ ਦੇ ਜੋ ਵੀ ਡਾਂਸ ਪ੍ਰਤੀ ਆਪਣੇ ਚਾਹ ਜਾਂ ਮਲਾਰ ਹੁੰਦੇ ਸੀ ਬੱਚਿਆਂ ਨੂੰ ਆਪਣੇ ਅੰਦਰ ਹੀ ਦਬਾ ਕੇ ਰੱਖਣੇ ਪੈਂਦੇ ਸਨ ਅੱਜ ਕੱਲ ਇਹ ਗਲਤ ਫਹਿਮੀ ਦੂਰ ਹੋ ਗਈ ਹੈ ਪਰ ਕਿਤੇ ਨਾ ਕਿਤੇ ਇਹ ਸੋਚ ਅੱਜ ਵੀ ਬਰਕਰਾਰ ਹੈ